ਸਾਡੇ ਵਿਆਹ ਨੂੰ ਅੱਜ ਦੋ ਤਿੰਨ ਸਾਲ ਹੋ ਗਏ ਹੈ ਅਤੇ ਮੇਰੀ ਘਰਵਾਲੀ ਨੂੰ ਬਹੁਤ ਸ਼ੌਕ ਆ ਪੌਦਿਆਂ ਦਾ ਤਾਂ ਕਿ ਉਹਨੇ ਵਿਚਾਰੀ ਨੇ ਮੈਨੂੰ ਲਾਇਆ ਹੈ ਇਸ ਚੀਜ਼ 'ਤੇ ਵੀ ਹਾਂ ਬਾਗਬਾਨੀ ਆਪਾਂ ਨੂੰ ਕਰਨੀ ਚਾਹੀਦੀ ਹੈਗੀ ਆਸੇ ਪਾਸੇ ਆਪਣੇ ਗਰੀਨਰੀ ਹੋਣੀ ਚਾਹੀਦੀ ਹੈਗੀ ਤਾਂ ਉਹਨਾਂ ਨੇ ਹੀ ਮੈਨੂੰ ਮੋਟੀਵੇਟ ਕੀਤਾ ਇਸ ਚੀਜ਼ ਦੁਆਰਾ ਬਾਕੀ ਮੈਂ ਹਰ ਸਾਲ ਪੌਦੇ ਲਾਉਂਦਾ ਰਹਿੰਦਾ ਪਿਛਲੇ ਸਾਲ ਮੈਂ ਆਪਣੇ ਕਾਲਜ ਆਦੇਸ਼ ਯੂਨੀਵਰਸਿਟੀ ਦੇ ਵਿੱਚ ਸੌ ਬੂਟੇ ਲਾਏ ਹੈ ਤਾਂ ਉਹਦੀ ਦੇਖਭਾਲ ਵੀ ਕੀਤੀ ਹੈ ਥੋੜ੍ਹੇ ਬਹੁਤ ਖਰਾਬ ਵੀ ਹੋ ਗਏ ਹੈ ਅਤੇ ਕਿਉਂਕਿ ਗਰਮੀ ਜ਼ਿਆਦਾ ਸੀਗੀ ਜਾਂ ਉਹਨਾਂ ਨੂੰ ਪਾਣੀ ਪ੍ਰੋਪਰ ਨਹੀਂ ਮਿਲ ਪਾਇਆ ਉਸ ਤੋਂ ਬਾਅਦ ਅੱਧੇ ਬੂਟੇ ਤਾਂ ਚੱਲ ਗਏ ਆ ਜਿਹਨਾਂ ਨੂੰ ਕੋਈ ਖਾਦ ਦੀ ਵੀ ਲੋੜ ਨਹੀਂ ਪਈ ਤਾਂ ਮੇਰੀ ਰੁਚੀ ਇਹਦੇ ਵਿੱਚ ਜ਼ਿਆਦਾ ਹੋ ਗਈ ਹੈ ਤਾਂ ਮੈਂ ਹੁਣ ਬੜਾ ਧਿਆਨ ਰੱਖਦਾ ਹਾਂ ਬਾਕੀ ਹੁਣ ਟੈਮਰੇਚਰ ਵੀ ਬਹੁਤ ਜ਼ਿਆਦਾ ਵੱਧ ਗਿਆ ਪੰਜਾਹ ਡਿਗਰੀ ਦੀ ਨੇੜੇ ਚਲਾ ਗਿਆ ਤਾਂ ਉਸ ਚੀਜ਼ ਤੋਂ ਬਚਣ ਦੇ ਲਈ ਮੇਰੇ ਦਿਮਾਗ 'ਚ ਇਹ ਵੀ ਚੀਜ਼ ਆਈ ਤਾਂ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹੈ ਜਿਹਦੇ ਕਰਕੇ ਆਪਣਾ ਐਨਵਾਇਰਮੈਂਟ ਆ ਜਿਹੜਾ ਹੈਲਦੀ ਰਹੇ ਤਾਂ ਅਸੀਂ ਇੱਕ ਸੌਖਾ ਜੀਵਨ ਜੀਅ ਸਕੀਏ